ਪੰਜਾਬ ਵਿੱਚ ਮੈਨੂੰ ਲੱਗਦਾ ਹੈ ਕਿ ਵਿੱਦਿਅਕ ਸੰਸਾਵਾ ਸੰਸਥਾਵਾਂ ਜਾਂ ਯੂਨੀਵਰਸਿਟੀਆਂ ਤਾਂ ਬਹੁਤ ਹੈ ਜਿੰਨਾ ਕੁ ਮੈਂ ਜਾਣਦਾ ਕਿ ਪੰਜਾਬ ਵਿੱਚ ਯੂਨੀਵਰਸਿਟੀਆਂ ਦੀ ਅਸੀਂ ਜੇਕਰ ਗੱਲ ਕੀਤੀ ਜਾਏ ਇੱਕ ਤਾਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ ਪੀ ਟੀ ਯੂ ਯੂਨੀਵਰਸਿਟੀ ਕਪੂਰਥਲਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਸਾਡੇ ਗੁਰਦਾਸਪੁਰ 'ਚ ਸ਼੍ਰੀ ਬੇਅੰਤ ਸਿੰਘ ਯੂਨੀਵਰਸਿਟੀ ਵੀ ਹੁਣ ਬਣ ਚੁੱਕੀ ਹੈ ਸੋ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਜੋ ਪੰਜਾਬ ਵਿੱਚ ਬਣੀਆਂ ਹਨ ਇਹ ਬਹੁਤ ਹੀ ਵਧੀਆ ਸਿਖਲਾਈ ਬੱਚਿਆਂ ਨੂੰ ਦੇ ਰਹੀਆਂ ਹਨ ਇਹਨਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕੋਰਸ ਹੈ ਜਿਹੜੇ ਕੋਰਸ ਕਰਕੇ ਬੱਚੇ ਕਾਫੀ ਕੁਝ ਸਿੱਖਦੇ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਵੇਂ ਰਹਿਣਾ ਕਿਵੇਂ ਖਾਣਾ ਕਿਵੇਂ ਚੱਲਣਾ ਇਹਦੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸਿਖਾਇਆ ਜਾਂਦਾ ਔਰ ਇਸ ਤੋਂ ਇਲਾਵਾ ਇਹਨਾਂ ਯੂਨੀਵਰਸਿਟੀਆਂ 'ਚ ਬੱਚੇ ਜਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਸ ਕਰਦੇ ਆ ਹਾਂ ਜਿਵੇਂ ਆਈ ਟੀ ਆਈ ਹੋ ਗਿਆ ਔਰ ਉਹਨਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਪੈਸੇ ਕਮਾਉਣ ਵਿੱਚ ਬੜੀ ਬੜੀ ਸਹੂਲਤ ਪ੍ਰਾਪਤ ਹੁੰਦੀ ਆ ਜਿਸ ਤਰ੍ਹਾਂ ਕੋਈ ਬੱਚਾ ਬੀਟੈੱਕ ਕਰ ਰਿਹਾ ਕੋਈ ਬੱਚਾ ਬੀਐਡ ਕਰ ਰਿਹਾ ਕੋਈ ਈਟੀਟੀ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਔਰ ਮੈਨੂੰ ਲੱਗਦਾ ਇਹਨਾਂ ਯੂਨੀਵਰਸਿਟੀਆਂ ਜਾਂ ਜਿਹੜੀਆਂ ਵਿਦਿਅਕ ਸੰਸਥਾਵਾਂ ਆ ਉਹਨਾਂ ਦਾ ਵਿਅਕਤੀ ਦੀ ਔਰ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਜਿਹਨੂੰ ਅਸੀਂ ਪੰਜਾਬੀ 'ਚ ਸਰਵ ਪੱਖੀ ਵਿਕਾਸ ਕਹਿ ਦਿੰਦੇ ਹਾਂ ਸਮਾਜਿਕ ਵਿਕਾਸ ਸਰੀਰਿਕ ਵਿਕਾਸ ਮਾਨਸਿਕ ਵਿਕਾਸ ਇਹ ਸਾਰੇ ਵਿਕਾਸ ਵਿੱਚ ਜਿਹੜੇ ਵਿਦਿਅਕ ਸੰਸਥਾਵਾਂ ਨੇ ਉਹ ਬਹੁਤ ਅੱਛੀ ਭੂਮਿਕਾ ਨਿਭਾਉਂਦੀਆਂ ਨੇ ਔਰ ਮੈਨੂੰ ਲੱਗਦਾ ਕਿ ਇਹਨਾਂ ਜਿਹੜੀਆਂ ਵੀ ਜਿੰਨੀਆਂ ਵੀ ਵਿੱਦਿਅਕ ਸੰਸਥਾਵਾਂ ਇਹਨਾਂ ਨੂੰ ਆਪਣੇ ਜਿਹੜੇ ਨਿੱਜੀ ਸਵਾਰਥ ਆ ਉਹਨਾਂ ਨੂੰ ਭੁੱਲ ਕੇ ਬੱਚਿਆਂ ਦੇ ਸਰਬ ਪੱਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜੋ ਬੱਚੇ ਆਪਣੀ ਜ਼ਿੰਦਗੀ ਵਿੱਚ ਅੱਗੇ ਜਾ ਕੇ ਕਾਮਯਾਬ ਹੋ ਸਕਣ ਔਰ ਕਿਸੇ ਦੇ ਅੱਗੇ ਉਹਨਾਂ ਨੂੰ ਹੱਥ ਫੈਲਾਣੇ ਨਾ ਪੈਣ ਸੋ ਇਹ ਸਾਰੀਆਂ ਯੂਨੀਵਰਸਿਟੀਆਂ ਹੁਣ ਤੱਕ ਅੱਛਾ ਕੰਮ ਕਰ ਰਹੀਆਂ ਨੇ ਧੰਨਵਾਦ